ਹੈਲੋ ਹਾਂਜੀ ਮੈਂ ਡੋਕਟਰ ਸਾਹਿਬ ਬੋਲ ਰਿਹਾ ਹਾਂ ਅਤੇ ਤੁਸੀਂ ਕਿਹੜੇ ਪਿੰਡ ਤੋਂ ਬੋਲ ਰਹੇ ਹੋ ਇਹ ਧਮੋਟ ਪਿੰਡ ਕਿੱਧਰਲੀ ਸਾਈਡ ਹੈਗਾ ਵਾ ਮੈਨੂੰ ਪਤਾ ਨਹੀਂ ਹੈ ਇਹਦੇ ਬਾਰੇ ਅੱਛਾ ਉ ਉੱਧਰਲੀ ਸਾਈਡ ਲੁਧਿਆਣੇ ਤੋਂ ਬਾਹਰ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਦੱਸੋ ਬਾਕੀ ਮਨਜੀਤ ਪਹਿਲਾਂ ਤੁਸੀਂ ਮੈਨੂੰ ਆਹ ਦੱਸੋ ਤੁਹਾਡੇ ਘਰ ਦੇ ਵਿੱਚ ਕਿੰਨੇ ਲੋਕ ਰਹਿੰਦੇ ਆ ਅਤੇ ਤੁਹਾਡੇ ਆਸ ਪਾਸ ਤੁਸੀਂ ਗਲੀ 'ਚ ਰਹਿੰਦੇ ਹੋ ਕਿ ਤੁਹਾਡਾ ਮਤਲਬ ਘਰ ਬਹੁਤ ਵੱਡਾ ਜ਼ਿਆਦਾ ਆ ਤੁਸੀਂ ਗਲੀ 'ਚ ਰਹਿੰਦੇ ਹੋ ਕੀ ਤੁਹਾਡਾ ਮਹੱਲੇ 'ਚ ਰਹਿੰਦੇ ਹੋ ਕਿੱਦਾਂ ਤੁਹਾਡਾ ਰਹਿਣ ਦਾ ਅੱਛਾ ਠੀਕ ਹੈ ਅਤੇ ਤੁਹਾਡੇ ਆਸ ਪਾਸ ਮਤਲਬ ਕਿੰਨੇ ਕੁ ਲੋਕ ਰਹਿ ਲੈਂਦੇ ਆ ਕ ਰਹਿੰਦੇ ਤੁਹਾਡੇ ਆਸ ਪਾਸ ਅਤੇ ਤੁਹਾਡੇ ਆਸ ਪਾਸ ਕੋਈ ਉਹ ਜਾਂਦੀ ਹੈ ਨਾਲੀ ਦੀ ਪਾਈਪ ਜਾਂ ਵਗੈਰਾ ਕੋਈ ਨਹਿਰ ਵਗੈਰਾ ਜਾਂ ਟੋਭਾ ਵਗੈਰਾ ਕੁਛ ਵੀ ਹੈਗਾ ਆ ਅਤੇ ਉਹ ਟੋਭਾ ਕਿੰਨੇ ਸਾਲ ਪੁਰਾਣਾ ਹੈ ਤੁਹਾਨੂੰ ਪਤਾ ਹੋਵੇਗਾ ਕਿੰਨੇ ਮਤਲਬ ਕਿੰਨਾ ਟੈਮ ਹੋ ਗਿਆ ਉੱਥੇ ਪਾਣੀ ਭਰੇ ਨੂੰ ਅਤੇ ਇਹ ਅਤੇ ਉਹ ਅਤੇ ਪਾਣੀ ਉਹ ਹੁਣ ਖੜ੍ਹਾ ਰਹਿੰਦਾ ਹੈ ਕਿ ਉੱਥੇ ਉਹ ਹੁਣ ਖੜ੍ਹਾ ਹੁੰਦਾ ਪਾਣੀ ਹੁਣ ਅਤੇ ਅਤੇ ਉੱਥੇ ਜਾਨਵਰ ਵਗੈਰਾ ਰਹਿੰਦੇ ਆ ਕਿ ਕਿ ਉੱਥੇ ਉਹ ਵੈਜੀਟੇਸ਼ਨ ਉੱਗੀ ਹੋਈ ਆ ਅਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਹਾਨੂੰ ਹੁਣ ਤੁਹਾਨੂੰ ਤੁਸੀਂ ਬਿਮਾਰ ਕਿਸ ਤਰ੍ਹਾਂ ਦੇ ਹੋ ਪਹਿਲਾਂ ਮੈਨੂੰ ਇਹ ਦੱਸੋ ਅੱਛਾ ਠੀਕ ਹੈ ਤਾਂ ਤੁਹਾਡੇ ਪੂਰੇ ਸਾਰੇ ਪਰਿਵਾਰ 'ਚ ਵੀ ਇੱਦਾਂ ਹੋ ਰਿਹਾ ਕਿ ਤੁਹਾਡੀ ਗਲੀ 'ਚ ਵੀ ਸਾਰਾ ਇੱਦਾਂ ਹੀ ਹੋ ਰਿਹਾ ਅਤੇ ਜਿਹੜੇ ਤੁਸੀਂ ਮਹੱਲੇ 'ਚ ਰਹਿੰਦੇ ਹੋ ਤਾਂ ਇਹਦਾ ਮਤਲਬ ਤੁਹਾਡੇ ਜਿਹੜੇ ਤੁਸੀਂ ਇਹ ਟੋਭਾ ਹੈਗਾ ਨਾ ਉੱਥੋਂ ਦੀ ਉੱਥੋਂ ਦੀ ਉੱਥੋਂ ਦੀ ਜਿਹੜਾ ਇਨਫੈਕਸ਼ਨ ਫੈਲਦੀ ਪਈ ਤੁਹਾਡੇ ਵੱਲ ਉੱਥੇ ਜਿਹੜੀ ਕਈ ਵਾਰ ਤੂੰ ਤੁਹਾਡੇ ਜਿਹੜੇ ਤੁਹਾਡੇ ਮਿ ਘਰਦੇ ਮਿਸਜ਼ ਹੁੰਦੇ ਹੈਗੇ ਆ ਉਹ ਉੱਥੋਂ ਟੋਭੇ ਵਾਲੀ ਜਿਹੜੀ ਸਬਜ਼ੀਆਂ ਹੁੰਦੀਆਂ ਤੋੜ ਕੇ ਅਤੇ ਲਿਆ ਕੇ ਬਣਾ ਦਿੰਦੇ ਹੈਗੇ ਹੈ ਕਈ ਵਾਰ ਕੁਝ ਲੋਕ ਇੱਦਾਂ ਵੀ ਕਰ ਦਿੰਦੇ ਆ ਹਾਂ ਤੇ ਇਹਦੇ ਇਹਦੇ ਇਹਨਾਂ ਦੇ ਇਸ ਕਰਕੇ ਆਪਣੇ ਟੋਭੇ ਦੇ ਜਿਹੜੇ ਮਾੜੇ ਬੈਕਟੀਰੀਆ ਵਗੈਰਾ ਹੁੰਦੇ ਆ ਉਹ ਸਬਜ਼ੀਆਂ 'ਚ ਆ ਜਾਂਦੇ ਹੈ ਜੇ ਜਿਹਦੇ ਨਾਲ ਸਾਡਾ ਜਿਹੜਾ ਸਾਡੀ ਆਪਾਂ ਖਾ ਲੈਂਦੇ ਹਾਂ ਹੁਣ ਫਿਰ ਉਹਦੇ ਨਾਲ ਸਾਨੂੰ ਬਿਮਾਰੀਆਂ ਹੋਣ ਵਿੱਚ ਬਿਮਾਰੀਆਂ ਹੋਣ ਦੇ ਇਹ ਕਾਰਨ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਆ ਇਸ ਚੀਜ਼ ਤੋਂ ਬਚਣ ਵਾਸਤੇ ਤਾਂ ਵੈਸੇ ਮੈਂ ਤਾਂ ਜ਼ਿਆਦਾ ਕੁਛ ਕਰ ਤਾਂ ਨਹੀਂ ਸਕਦਾ ਹੈ ਇਹ ਇਹ ਤਾਂ ਸਰਕਾਰ ਦਾ ਮੇਨ ਕੰਮ ਹੈਗਾ ਆ ਮੈਂ ਤੁਹਾਨੂੰ ਇਹ ਦੱਸ ਦਿੰਦਾ ਤੁਸੀਂ ਇਹ ਤੋਂ ਬਚ ਕਿੱਦਾਂ ਸਕਦੇ ਹੈਗੇ ਹੋ

ਖਾਣ ਤੁਸੀਂ ਖਾਣ ਪੀਣ ਦਾ ਪਹਿਲੀ ਗੱਲ ਤਾਂ ਦੇਖੋ ਦਵਾਈਆਂ ਮਾ ਮਾਰਕੀਟ ਬਜ਼ਾਰੋਂ ਜਾ ਕੇ ਮੈਡੀਕਲ ਹਾ ਮੈਡੀਕਲ ਦੀ ਦਕਾਨ 'ਤੇ ਜਾ ਕੇ ਪਹਿਲਾਂ ਦਵਾਈ ਲੈ ਕੇ ਆਓ ਇੱਕ ਪੈਰਾਸੀਟਾਮੋਲ ਅਤੇ ਟਾਇਗਨ ਫੋਡ ਤੇ ਲੀ ਲੀਵੋਸਿਟਰੀਜਿਨ ਇਹ ਦਵਾਈ ਲੈ ਕੇ ਆਇਓ ਇਹਦੇ ਇਹਦੇ ਤੁਸੀਂ ਦਿਨ ਦੇ ਵਿੱਚ ਇਹ ਤਿੰਨੋਂ ਗੋਲੀਆਂ ਤੁਸੀਂ ਦਿਨ ਦੇ ਵਿੱਚ ਦੋ ਡੋਜ ਲੈਣੇ ਹੈ ਇੱਕ ਸਵੇਰੇ ਇੱਕ ਸ਼ਾਮੀ ਰੋਟੀ ਖਾਣ ਤੋਂ ਬ ਬ ਬਾਅਦ ਨਹੀਂ ਨਹੀਂ ਨਹੀਂ ਨਾਲ ਦੀ ਕੁਛ ਨਹੀਂ ਲੈਣਾ ਅਤੇ ਜਿਹੜੀ ਤੁਸੀਂ ਹੁਣ ਘਰ ਜਿਹੜੇ ਸਬਜ਼ੀਆਂ ਲੈ ਰਹੇ ਹੋ ਉਹ ਸਬਜ਼ੀ ਤੁਸੀਂ ਚੰਗੀ ਤਰ੍ਹਾਂ ਧੋਣੀ ਹੈਗੀ ਆ ਉਹ ਸਬਜ਼ੀ ਜਿਹੜੀ ਕਰੁੰਗੇ ਚੰਗੀ ਤਰ੍ਹਾਂ ਪਾਣੀ 'ਚ ਗਰਮ ਕਰਕੇ ਚੰਗੀ ਤਰ੍ਹਾਂ ਉਬਾਲ ਕੇ ਤੁਸੀਂ ਕੁਛ ਦਿਨ ਉਬਾਲ ਕੇ ਖਾਇਓ ਅਤੇ ਆਪਣੇ ਘਰਦਿਆਂ ਨੂੰ ਕਿਹੋ ਉਬਾਲ ਕੇ ਖਾਇਓ ਅਤੇ ਅੱਜ ਹੁਣ ਤੁਸੀਂ ਅੱਜ ਸਵੇਰੇ ਕੀ ਖਾਧਾ ਸੀਗਾ ਅੱਜ ਅੱਜ ਅੱਜ ਤੁਸੀਂ ਅੱਜ ਸਵੇਰੇ ਕੀ ਖਾਧਾ ਸੀਗਾ ਅਤੇ ਉਹ ਮੇਥੀ ਉੱਥੋਂ ਤੋੜ ਕੇ ਲੈ ਕੇ ਆਏ ਸੀ ਕਿ ਬਜ਼ਾਰੋਂ ਲੈ ਕੇ ਆਏ ਸੀ ਫਿਰ ਜਾਂ ਤਾਂ ਤੁਹਾਨੂੰ ਇਨਫੈਕਸ਼ਨ ਹੋ ਗਈ ਆ ਜਾਂ ਤਾਂ ਤੁਹਾਡਾ ਫਿਰ ਉਹ ਇਮਿਊਨਿਟੀ ਸਿਸਟਮ ਲੋਅ ਹੋ ਗਿਆ ਹੋਣਾ ਕਈ ਵਾਰ ਵੈਸੇ ਨੌਰਮਲ ਜਿਹੀ ਗੱਲ ਹੈ ਹੁੰਦਾ ਰਹਿੰਦਾ ਲੋਕਾਂ ਦਾ ਤੁਸੀਂ ਇਹ ਤੁਸੀਂ ਡਰੋ ਨਾ ਤੁਸੀਂ ਡਰੋ ਨਾ ਹਾਂ ਇਹ ਅ ਜ਼ਿਆਦਾਤਰ ਲੋਕ ਇਹ ਚੀਜ਼ਾਂ ਨੂੰ ਦੇਖ ਕੇ ਡਰ ਜਾਂਦੇ ਹੈਗੇ ਆ ਤਾਂ ਇਹ ਡਰਨ ਵਾਲੀ ਕੋਈ ਕੰ ਕੰਮ ਨਹੀਂ ਹੈਗੇ ਤੁਹਾਨੂੰ ਬਸ ਸੋਚ ਸਮਝ ਕੇ ਖਾਣਾ ਆ ਅਤੇ ਅ ਉਸ ਟੋਭੇ ਦੇ ਆਸ ਪਾਸ ਟੋਭੇ ਦਾ ਕੁਛ ਕਰੋ ਤੁਸੀਂ ਉਸ ਕੋਲੋਂ ਹੈ ਬਿਮਾਰੀ ਫੈਲਦੀ ਹੈਗੀ ਹੈ ਟੋਭੇ ਕੋਲ ਉਹ ਖੜ੍ਹਾ ਜਦੋਂ ਹਾਂਜੀ ਖੜ੍ਹੇ ਪਾਣੀ ਜਦੋਂ ਖੜ੍ਹਾ ਪਾਣੀ ਹੁੰਦਾ ਉਦੋਂ ਇਨਫੈਕਸ਼ਨ ਫੈਲ ਜਾਂਦੀ ਹੈਗੀ ਆ ਅਤੇ ਅਗਰ ਤੁਹਾਨੂੰ ਹੋਰ ਕਿਤੇ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਮੇਰੇ ਹੌਸਪੀਟਲ ਆ ਸਕਦੇ ਹੋ ਮੇਰਾ ਹੌਸਪੀਟਲ ਹੈਗਾ ਆ ਮੇਰਾ ਹੌਸਪੀਟਲ ਹੈਗਾ ਸਮਰਾਲਾ ਚੌਂਕ ਗੁਪਤਾ ਹੌਸਪੀਟਲ ਨਾਮ ਹੈਗਾ ਹੈ ਉੱਥੇ ਨਾਮ ਲੈ ਦਿਓ ਗੁਪਤਾ ਹੋਇਆ ਮੇਰਾ ਉੱਥੇ ਬਸ ਕਹਿ ਦਿਓ ਵੀ ਮਹੀਸ਼ ਗੁਪਤਾ ਮਿਲਣਾ ਹੈ ਮੇਰਾ ਨਾਮ ਮਹੀਸ਼ ਗੁਪਤਾ ਹੈਗਾ ਆ ਠੀਕ ਹੈ ਮੈਂ ਨਾ ਉੱਥੇ ਹੁੰਦਾ ਹਾਂ ਮੈਂ ਨਾ ਉੱਥੇ ਸਾਢੇ ਨੌਂ ਤੋਂ ਲੈ ਕੇ ਅਤੇ ਸਾ ਸਾਢੇ ਢੇਡ ਵਜੇ ਤੱਕ ਬਹਿਨਾ ਹੈਗਾ ਹੈ ਤੁਸੀਂ ਉਦੋਂ ਆ ਸਕਦੇ ਹੋ ਅਤੇ ਤੁਹਾਡੀ ਪ੍ਰਿਸਕ੍ਰਿਪਸ਼ਨ ਮੈਂ ਲਿਖ ਦੂੰਗਾ ਠੀਕ ਹੈ ਧੰਨਵਾਦ